ਮੇਰੇ ਲਈ ਸਭ ਤੋਂ ਅਣਕਿਆਸੀ ਚੀਜ਼ ਲੋਕਡਾਊਨ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਜਾਨ ਮਾਲ ਜਾਨ ਮਾਲ ਦਾ ਨੁਕਸਾਨ ਹੋਇਆ ਹੈ ਜਿਸ ਦੇ ਨਾਲ ਐਜੂਕੇਸ਼ਨ 'ਤੇ ਬਹੁਤ ਵੱਡਾ ਅਫੈਕਟ ਪਿਆ ਹੈ ਜਿਸ ਦੇ ਨਾਲ ਜਿਹੜੇ ਵਿਦਿਆਰਥੀ ਹੈ ਉਹਨਾਂ ਦੇ ਸਿੱਖਿਆ ਦਾ ਪੱਧਰ ਬਹੁਤ ਜ਼ਿਆਦਾ ਹੀ ਨੀਵਾਂ ਹੋ ਗਿਆ ਹੈ ਉਹਨਾਂ ਨੂੰ ਪੜ੍ਹਨ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਜ਼ ਹੁੰਦੀਆਂ ਹਨ ਜਿਸ ਦੇ ਕਾਰਨ ਇਸ ਦਾ ਲੋਕਡਾਊਨ 'ਤੇ ਲੋਕਡਾਊਨ ਦਾ ਸਭ 'ਤੇ ਬਹੁਤ ਜ਼ਿਆਦਾ ਬੈਡ ਇਫੈਕਟ ਪਿਆ ਹੈ ਪਰ ਇ ਇਸਦੇ ਵਿੱਚ ਇੱਕ ਚੰਗੀ ਗੱਲ ਇਹ ਹੈ ਕਿ ਇਸ ਦੇ ਨਾਲ ਜਿਹੜਾ ਸਾਡਾ ਵਾਤਾਵਰਨ ਹੈ ਉਹ ਬਹੁਤ ਜ਼ਿਆਦਾ ਹੀ ਸਾਫ ਹੋ ਗਿਆ ਹੈ ਅਤੇ ਇਸਦੇ ਬ ਸਾਫ਼ ਵਾਤਾਵਰਨ ਵਿੱਚ ਮੈਨੂੰ ਤਸਵੀਰਾਂ ਖਿੱਚਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਖਿੱਚੀਆਂ ਜਿਵੇਂ ਕਿਸੇ ਸੋਹਣੇ ਜਿਹੇ ਦਰੱਖਤ ਫੁੱਲਾਂ ਦੀਆਂ ਹੋਗੀਆਂ ਕੋਈ ਤਸਵੀਰਾਂ ਹੋਗੀਆਂ ਕੋਈ ਆਰਟ ਕ੍ਰਾਫਟ ਹੋ ਗਿਆ ਕੋਈ ਪੁਸਤ ਅ ਕਿਸੇ ਪੁਸਤਕ ਵਿੱਚ ਕੋਈ ਸੋਹਣੀ ਤਸਵੀਰ ਹੋ ਗਈ ਇਹਨਾਂ ਸਭ ਦੀਆਂ ਫੋਟੋਆਂ ਖਿੱਚੀਆਂ ਅਤੇ ਮੈਨੂੰ ਕਿਸੇ ਕ ਉੱਚੀ ਪਹਾੜੀ ਦੀ ਬਹੁਤ ਸੋਹਣੀ ਫੋਟੋ ਖਿੱਚੀ ਬਹੁਤ ਸੋਹਣੀ ਫੋਟੋ ਖਿੱਚੀ ਹੈ ਜਿਸ ਨੂੰ ਮੈਂ ਖਿੱਚ ਕੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ ਅਤੇ ਇਨ ਇਸ ਇਸ 'ਤੇ ਮੈਨੂੰ ਬਹੁਤ ਸਾਰੇ ਲਾਇਕਸ ਮਿਲੇ ਹਨ ਅਤੇ ਮੈਨੂੰ ਇਹ ਸਭ ਚੀਜ਼ਾਂ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ